ਜਿੱਥੇ ਅਸੀਂ ਰਹਿੰਦੇ ਹੈਗੇ ਉ ਉਸ ਖੇਤਰ ਵਿੱਚ ਕੁਛ ਲੋਕ ਸਾਡੇ ਨਾਲ ਮੁਸਲਮਾਨ ਵੀ ਰਹਿੰਦੇ ਆ ਹਿੰਦੂ ਵੀ ਰਹਿੰਦੇ ਆ ਅਤੇ ਸਾਡੇ ਆਪਣੇ ਆਪ ਦੇ ਸੱਭਿਆਚਾਰਕ ਲੋਕ ਵੀ ਰਹਿੰਦੇ ਗੇ ਸਾਡਾ ਇਹ ਫਰਕ ਹੈ ਕਿ ਵੀ ਸਾਡੀਆਂ ਜਿਹੜੀਆਂ ਅਸੀਂ ਜਿਹੜੇ ਲੋਕਾਂ ਅੱਗੇ ਵੀ ਅਸੀਂ ਬੁਰਕਾ ਨਹੀਂ ਪਹਿਨਦੇ ਜਿਵੇਂ ਮੁਸਲਮਾਨ ਲੋਕ ਜਿਹੜੇ ਉਹਨਾਂ ਦੇ ਸੱਭਿਆਚਾਰ 'ਚ ਰਹਿਣ ਪਹਿਨ ਦਾ ਵੀ ਆ ਜਾਂਦਾ ਫਰਕ ਆਪਣਾ ਖਾਣ ਪੀਣ ਦਾ ਵੀ ਬੋਲ ਚਾਲ ਦਾ ਵੀ ਫਰਕ ਆ ਜਾਂਦਾ ਗਾ ਅਤੇ ਪ੍ਰੋਗਰਾਮਾਂ ਦਾ ਵੀ ਫਰਕ ਆ ਜਾਂਦਾ ਗਾ ਜਿਵੇਂ ਵੀ ਸਾਡੇ ਪ੍ਰੋਗਰਾਮ ਹੋਰ ਸ ਟੈਪ ਨਾਲ ਅਸੀਂ ਮਨਾਉਦੇ ਹਾਂ ਅਤੇ ਉਹ ਆਪਦੀ ਹੋਰ ਨਾਲ ਵਿਆਹ ਦੇ ਵਿੱਚ ਕੋਈ ਹੋਰ ਅਤੇ ਮੁਸਲਮਾਨ ਲੋਕ ਆ ਜਿਹੜੇ ਉਹ ਜ਼ਿਆਦਾਤਰ ਬੁਰਕਾ ਪਹਿਨਦੀਆਂ ਨੇਗੀਆਂ ਜਿਹੜੀਆਂ ਉਹਨਾਂ ਦੀਆਂ ਔਰਤਾਂ ਨੇਗੀਆਂ ਅਤੇ ਜਿਹੜੀਆਂ ਸਾਡੀਆਂ ਔਰਤਾਂ ਨੇ ਇਹ ਸਿਰਫ ਸਿਰ 'ਤੇ ਦੁਪੱਟਾ ਰੱਖਦੀਆਂ ਨੇਗੀਆਂ ਜਿਵੇਂ ਅਸੀਂ ਲੋਕ ਹਾਂ ਜਿਹੜੇ ਆਨੰਦ ਕਾਰਜ ਕਰਨ ਵੇਲੇ ਲਾਵਾਂ ਲੈਂਦੇ ਹੈਗੇ ਅਤੇ ਉਹ ਲੋਕ ਹੈਗੇ ਜਿਹੜੇ ਉਹ ਆਪਾਂ ਜਿਹੜੇ ਪੰਜਾਬੀ ਲੋਕ ਆ ਉਹ ਫੇਰੇ ਲੈਂਦੇ ਆ ਦੂਜੇ ਲੋਕ ਲਾਵਾਂ ਲੈਂਦੇ ਹੈਗੇ ਅਤੇ ਇਹ ਫਰਕ ਆ ਜਾਂਦਾ ਸਾਡੇ ਦੇ ਵਿੱਚ ਅਤੇ ਜਿਵੇਂ ਅਸੀਂ ਕਈ ਵਾਰ ਆਪਦੇ ਰਿਸ਼ਤੇਦਾਰੀਆਂ 'ਚ ਜਾਂਦੇ ਹਾਂ ਜਦੋਂ ਉਹ ਸਾਡੀਆਂ ਰਿਸ਼ਤੇਦਾਰੀਆਂ ਪੰ ਹਰਿਆਣੇ 'ਚ ਨੇਗੀਆਂ ਤਾਂ ਹਰਿਆਣੇ 'ਚ ਜਿਹੜੇ ਬਾਗੜੀਏ ਲੋਕ ਰਹਿੰਦੇ ਆ ਉਹਨਾਂ ਦੇ ਵੀ ਰਹਿਣ ਸਹਿਣ ਦਾ ਬੋਲ ਚਾਲ ਦਾ ਉਹਨਾਂ ਦੇ ਪ੍ਰੋਗਰਾਮਾਂ ਦਾ ਵਿਆਹਾਂ ਦਾ ਫੰਕਸ਼ਨਾਂ ਦਾ ਫਰਕ ਪੈ ਜਾਂਦਾ ਸਾਡੇ ਲੋਕਾਂ ਨਾਲੋਂ ਅਤੇ ਸਾਨੂੰ ਇਹ ਵੀ ਚੀਜ਼ ਦੇਖਣ ਨੂੰ ਮਿਲਦੀ ਹੈਗੀ ਕਿ ਉਹਨਾਂ ਦਾ ਵੀ ਪ੍ਰੋਗਰਾਮ ਕਿਸ ਤਰ੍ਹਾਂ ਦੇ ਹੁੰਦੇ ਆ ਜਾਂ ਉਹਨਾਂ ਦੀ ਬੋਲ ਚਾਲ ਕਿਵੇਂ ਹੁੰਦੀ ਹੈਗੀ ਉਹ ਜ਼ਿਆਦਾਤਰ ਲੋਕ ਪਹਿਰਾਵੇ ਦਾ ਵੀ ਫਰਕ ਆ ਜਾਂਦਾ ਸਾਡੀ ਸਲਵਾਰ ਕਮੀਜ ਪਾਉਂਦੇ ਜਿਵੇਂ ਉਹ ਉੱਧਰਲੇ ਲੋਕ ਹਰਿਆਣਵੀ ਬਾਗੜੀਏ ਲੋਕ ਘੱਗਰੇ ਪਾਉਂਦੇ ਹੈਗੇ ਮੁਸਲਮਾਨ ਲੋਕ ਬੁਰਕਾ ਪਾਨ ਪਹਿਨਦੇ ਹੈਗੇ ਹਿੰਦੂ ਲੋਕ ਆ ਜਿਹੜੇ ਉਹ ਜ਼ਿਆਦਾਤਰ ਉਹਨਾਂ ਦੇ ਵਿਹਾਰਾਂ 'ਚ ਵੀ ਫਰਕ ਆ ਜਾਂਦਾ ਉਹਨਾਂ ਦੇ ਪ੍ਰੋਗਰਾਮ 'ਚ ਵਿਆਹਾਂ 'ਚ ਸ਼ਾਦੀਆਂ 'ਚ ਬਹੁਤ ਫਰਕ ਆ ਜਾਂਦਾ ਸਾਡੇ ਨਾਲੋਂ ਸਾਰੇ ਕੁਛ ਸੱਭਿਆਚਾਰਾਂ ਦਾ ਸਾਰੇ ਸੱਭਿਆਚਾਰ ਅਲੱਗ ਅਲੱਗ ਨੇਗੇ